ਇੱਕ ਜਨਵਰੀ ਉੱਨੀ ਸੌ ਨੜਿਨਵੇਂ ਅੱਠ ਫਰਵਰੀ ਉੱਨੀ ਸੌ ਪੰਜਾਹ ਦਹ ਦਸ ਜਨਵਰੀ ਉੱਨੀ ਸੌ ਇਕਿਆਸੀ ਵੀਹ ਮਾਰਚ ਠਾ ਅਠਾਰ੍ਹਾਂ ਸੌ ਤਰਵੰਜਾ ਸਤਾਈ ਮਾਰਚ ਅਠਾਰ੍ਹਾਂ ਸੌ ਚੌਂਤੀ